ਹਾਂਜੀ ਅੱਜ ਤੋਂ ਦੋ ਕੁ ਮਹੀਨੇ ਪਹਿਲਾਂ ਮੈਂ ਔਨਲਾਈਨ ਇੱਕ ਕੁੜਤਾ ਬੁੱਕ ਕੀਤਾ ਸੀਗਾ ਜਿਹੜਾ ਕਿ ਜਦੋਂ ਮੈਂ ਰਸੀਵ ਕੀਤਾ ਤਾਂ ਉਹ ਇੰਨਾਂ ਕੁ ਸੋਹਣਾ ਕੁੜਤਾ ਮੈਨੂੰ ਰਿਸੀਵ ਹੋਇਆ ਅਤੇ ਮੇਰਾ ਮੇਰਾ ਮਨ ਇੰਨਾਂ ਖੁਸ਼ ਹੋਇਆ ਉਸ ਕੁੜਤੇ ਨੂੰ ਦੇਖ ਕੇ ਮੈਨੂੰ ਇੰਝ ਲੱਗਿਆ ਕਿ ਮੈਂ ਜਿੰਨੇ ਉਸ ਕੁੜਤੇ 'ਤੇ ਪੈਸੇ ਲਾਏ ਉਹ ਸਾਰੇ ਮੇਰੇ ਵਸੂਲੇ ਗਏ ਸੇਮ ਕੁੜਤਾ ਜਦੋਂ ਮੈਂ ਵੇਅਰ ਕੀਤਾ ਆਪਣੇ ਔਫਿਸ ਦੇ ਵਿੱਚ ਤਾਂ ਮੇਰੀ ਫਰੈਂਡ ਨੇ ਵੀ ਜਿੱਦ ਕੀਤੀ ਕਿ ਮੈਨੂੰ ਸੇਮ ਐਜ਼ ਇਟ ਇਜ਼ ਕੁੜਤਾ ਮੈਨੂੰ ਤੂੰ ਔਡਰ ਕਰਕੇ ਦੇ ਸੋ ਮੈਂ ਉਹਦੇ ਲਈ ਵੀ ਉਸੇ ਦਿਨ ਸੇਮ ਕੁੜਤਾ ਔਰਡਰ ਕਰਤਾ ਅਤੇ ਸਾਨੂੰ ਪੰਜ ਕੁ ਦਿਨਾਂ ਬਾਅਦ ਉਹ ਕੁੜਤਾ ਡਿਲੀਵਰ ਹੋਇਆ ਜਦੋਂ ਅਸੀਂ ਉਹ ਕੁੜਤਾ ਦੇਖਿਆ ਤਾਂ ਮੇਰਾ ਮਨ ਇੰਨਾਂ ਕੁ ਹਰਾਸ਼ ਹੋਇਆ ਅਤੇ ਇੰਨਾਂ ਪਰੇਸ਼ਾਨ ਹੋਇਆ ਕਿ ਸ ਉਹ ਦੋਨਾਂ ਕੁੜਤਿਆਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਸੀਗਾ ਪਹਿਲਾਂ ਤਾਂ ਉਹਦਾ ਰੰਗ ਇੰਨਾਂ ਫਿਟਿਆ ਹੋਇਆ ਸੀ ਇੰਨਾਂ ਡਲ ਕਲਰ ਮੈਨੂੰ ਰਿਸੀਵ ਹੋਇਆ ਅਤੇ ਪਹਿਲਾਂ ਤਾਂ ਸਾਡਾ ਮਨ ਦੋਨਾਂ ਦਾ ਰੰਗ ਦੇਖ ਕੇ ਹੀ ਕੁੜਤੇ ਦਾ ਇੰਨਾਂ ਜ਼ਿਆਦਾ ਖਰਾਬ ਹੋਇਆ ਚਲੋ ਗੱਲ ਕਰੀਏ ਕਢਾਈ ਦੀ ਕੁੜਤੇ ਦੇ ਉੱਪਰ ਤਾਂ ਇੰਨੇ ਕੁ ਜ਼ਿਆਦਾ ਕਢਾਈ ਖਰਾਬ ਕੀਤੀ ਹੋਈ ਸੀ ਹੱਥ ਦੀ ਕਢਾਈ ਸੀਗੀ ਅਤੇ ਇੰਨੀ ਕੁ ਜ਼ਿਆਦਾ ਖਰਾਬ ਮਟੀਰੀਅਲ ਲਗਾਇਆ ਹੋਇਆ ਸੀਗਾ ਕਿ ਉਹਨੂੰ ਪਹਿਨਣ ਦਾ ਵੀ ਮਨ ਨਹੀਂ ਸੀ ਸੋ ਮੇਰਾ ਇੰਨਾਂ ਕੁ ਮਨ ਖਰਾਬ ਹੋਇਆ ਅਤੇ ਮੈਂ ਆਪਣੀ ਫਰੈਂਡ ਨੂੰ ਕਿਹਾ ਕਿ ਇਸ ਕੁੜਤੇ ਦੀ ਜੋ ਪੇਮੈਂਟ ਹੈ ਉਹ ਮੈਂ ਹੀ ਕਰਾਂਗੀ ਕਿਉਂਕਿ ਇਹ ਮੇਰੀ ਗਲਤੀ ਹੈ ਕਿ ਮੈਂ ਚੰਗੀ ਤਰ੍ਹਾਂ ਪ੍ਰੋਡਕਟ ਨੂੰ ਜਾਂਚ ਕੇ ਇਹ ਔਰਡਰ ਨਹੀਂ ਕੀਤਾ ਹੈਗਾ